ਭਾਰਤੀ ਨੌਕਰੀ ਬਾਜ਼ਾਰ ਦਾ ਢਾਂਚਾ ਬਿਲਕੁਲ ਹੀ ਵਿਗੜ ਚੁੱਕਾ ਹੈ ਇਸ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਠੇਕੇਦਾਰੀ ਕੰਮ ਹੀ ਚੱਲ ਰਿਹਾ ਹੈ ਕਿਸੇ ਵੀ ਵਿਅਕਤੀ ਨੂੰ ਉਸਦੇ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ ਅਤੇ ਜੇਕਰ ਕਿਸੇ ਨੂੰ ਮਿਲਦੀ ਹੈ ਤਾਂ ਉਸਨੂੰ ਵੀ ਰਿਸ਼ਵਤ ਦੇ ਕੇ ਮਿਲਦੀ ਹੈ ਜਿਹੜਾ ਉਸ ਵਿਅ ਜਿਹੜਾ ਵਿਅਕਤੀ ਉਸ ਕੰਮ ਲਈ ਯੋਗ ਹੁੰਦਾ ਹੈ ਉਹਨੂੰ ਇਹ ਨੌਕਰੀ ਨਹੀਂ ਦਿੱ ਦਿੱਤੀ ਜਾਂਦੀ ਸਗੋਂ ਜਿਸਦੇ ਕੋਲ ਪੈਸੇ ਹੁੰਦੇ ਹਨ ਉਸਨੂੰ ਨੌਕਰੀ ਦਿੱਤੀ ਜਾਂਦੀ ਹੈ ਇਸ ਨਾਲ ਸਾਡੇ ਸਮਾਜ ਵਿੱਚ ਵੀ ਗ਼ਲਤ ਕੰਮ ਬਹੁਤ ਵੱਧ ਰਿਹਾ ਹੈ ਲੋਕ ਜੋ ਚੰਗੇ ਕੰਮ ਕਰਨ ਵਾਲੇ ਹਨ ਉਹ ਗ਼ਲਤ ਕੰਮਾਂ ਵਿੱਚ ਲੱਗ ਗਏ ਹਨ ਅਤੇ ਜਿਨ੍ਹਾਂ ਕੋਲ ਪੈਸੇ ਹੈ ਉਹਨਾਂ ਦੀ ਹੀ ਨੌਕਰੀ ਹੈ ਜਿਸ ਕਾਰਨ ਸਾਡੇ ਪਰਿਵਾਰ ਦਾ ਵੀ ਵਿੱਤੀ ਢਾਂਚਾ ਬਿਲਕੁਲ ਖਰਾਬ ਹੋ ਗਿਆ ਹੈ ਅੱਜ ਕੱਲ੍ਹ ਵਿੱਚ ਨੌਕਰੀ ਇੱਕ ਬਾਜ਼ਾਰ ਹੀ ਬਣ ਚੁੱਕਿਆ ਹੈ ਜਿਸ ਵਿੱਚ ਕਿ ਜੇਕਰ ਨੌਕਰੀ ਮਿਲ ਕਰਦੇ ਹਨ ਜਿਹੜੇ ਲੋਕ ਉਹਨਾਂ ਨੂੰ ਵੀ ਇੱਕ ਬਿਲਕੁਲ ਨੀਵੀਂ ਜਾਤ ਦਾ ਸਮਝਿਆ ਜਾਂਦਾ ਹੈ ਅਤੇ ਉਹਨਾਂ ਨੂੰ ਤਨਖਾਹ ਵੀ ਟੈਮ ਸਿਰ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਂਦੀਆਂ ਹਨ ਜਿਵੇਂ ਕਿ ਮਹਿੰਗਾਈ ਵੱਧ ਰਹੀ ਹੈ ਉਸਦੇ ਹਿਸਾਬ ਨਾਲ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਕੰਮ ਉਹਨਾਂ ਤੋਂ ਦੁੱਗਣਾ ਲਿਆ ਜਾਂਦਾ ਹੈ